ਪਿਛਲੇ ਸਾਲਾਂ ਦੌਰਾਨ ਜੋ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਿਆ ਇਹ ਪਹਿਲਾ ਪਟਿਆਲੇ ਜਿਲ੍ਹੇ ਵਿੱਚ ਇਲਾਕਾ ਸ਼ਾਮਿਲ ਸੀ ਅਤੇ ਬੇਅੰਤ ਸਿੰਘ ਸੀ ਐੱਮ ਸਰਕਾਰ ਨੇ ਇਹਨੂੰ ਪਟਿਆਲੇ ਵਿੱਚੋਂ ਕੱਟ ਕੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਾਇਆ ਅਤੇ ਹੁਣ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਜੋ ਕਿ ਇੱਕ ਐਜੂਕੇਸ਼ਨ ਦੀ ਹੱਬ ਬਣ ਚੁੱਕਿਆ ਇਸ ਵਿੱਚ ਇੰਜੀਨੀਅਰ ਕਾਲਜ ਬਾਬਾ ਬੰਦਾ ਸਿੰਘ ਬਹਾਦਰ ਅਤੇ ਵਰਲਡ ਯੂਨੀਵਰਸਿਟੀ ਅਤੇ ਮਾਤਾ ਗੁਜਰੀ ਕਾਲਜ ਜਿਹੜਾ ਕਿ ਬਹੁਤ ਪੁਰਾਣਾ ਐਜੂਕੇਸ਼ਨ ਕਾਲਜ ਹੈ ਉਹ ਸ਼ਾਮਿਲ ਹੈ ਇਸ ਤੋਂ ਬਿਨਾਂ ਹੁਣ ਕਾ ਇੰਜਨੀ ਇਹ ਐਜੂਕੇਸ਼ਨ ਦੀ ਹੱਬ ਹੋਣ ਕਾਰਨ ਇੱਥੇ ਬਹੁਤ ਸਾਰੇ ਪੀ ਜੀ ਬਣ ਚੁੱਕੇ ਆ ਬਿਜ਼ਨਸ ਪੁਆਇੰਟ ਲਈ ਅਤੇ ਬੱਚਿਆਂ ਦੇ ਖਾਣ ਲਈ ਬਹੁਤ ਸਾਰੇ ਹੋਟਲ ਰੈਸਟੋਰੈਂਟ ਬਣ ਚੁੱਕੇ ਨੇ ਜੋ ਕਿ ਬਿਜਨਸ ਪੁਆਇੰਟ ਦੀ ਬੜੀ ਸਿਖਰ ਹੈ ਹੁਣ ਇਸ ਵਿੱਚ ਇੱਕ ਸੁੰਦਰ ਬਸ ਸਟੈਂਡ ਵੀ ਬਣ ਚੁੱਕਿਆ ਜਿਹੜਾ ਕਿ ਜੀ ਟੀ ਰੋਡ ਕੋਲ ਬਾਬਾ ਬੰਦਾ ਸਿੰਘ ਬਹਾਦਰ ਟਰਮੀਨਲ ਨਾਂ ਨਾਲ ਬਣ ਚੁੱਕਿਆ ਅਤੇ ਉਸ ਤੋਂ ਬਿਨਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਇੱਕ ਚਕਰੇਸ਼ਵਰੀ ਦੇਵੀ ਮੰਦਰ ਰੋਜਾ ਸ਼ਰੀਫ ਮੁਸਲਮਾਨਾਂ ਦੀ ਦਰਗਾਹ ਸ਼ਾਮਿਲ ਹੈ ਅਤੇ ਦੋ ਗੁਰਦੁਆਰਾ ਸਾਹਿਬਾਨ ਜਿ ਜਿਸ ਦਾ ਨਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਾਂ 'ਤੇ ਰੱਖਿਆ ਗਿਆ ਹੈ ਫਤਿਹਗੜ੍ਹ ਸਾਹਿਬ ਗੁਰਦੁਆਰਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਲਗਭਗ ਸੱਤ ਸਾਲ ਅਤੇ ਨੌ ਸਾਲ ਦੀ ਉਮਰ ਵਿੱਚ ਨੀਹਾਂ ਵਿੱਚ ਚਿਣਾ ਕੇ ਸ਼ਹੀਦ ਕੀਤਾ ਗਿਆ ਸੀ ਅਤੇ ਗੁਰਦੁਆਰਾ ਜੋਤੀ ਸਰੂਪ ਜਿਸ ਜਗ੍ਹਾ ਬਾਬਾ ਟੋਡਰ ਮੱਲ ਜੀ ਨੇ ਸੋਨੇ ਦੀਆਂ ਖੜੀਆਂ ਮੋਹਰਾਂ ਵਿਛਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਸੀ ਉਸ ਜਗ੍ਹਾ ਨੂੰ ਅੱਜ ਕੱਲ੍ਹ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਦਾ ਮਾਣ ਹੋਣ ਦਾ ਹਾਸਲ ਹੈ ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਦੀ ਹੁਣ ਮੰਨੀ ਜਾਂਦੀ ਹੈ ਇਸ ਤਰ੍ਹਾਂ ਇਹ ਜ਼ਿਲ੍ਹਾ ਹੁਣ ਬਹੁਤ ਸਾਰੀਆਂ ਤਬਦੀਲੀਆਂ ਨਾਲ ਬਹੁਤ ਸਾਰੀ ਤਰੱਕੀਆਂ ਨਾਲ ਅਤੇ ਬੁਨਿਆਦੀ ਸਹੂਲਤਾਂ ਨਾਲ ਆਪਣੀ ਤਰੱਕੀ 'ਤੇ ਹੈ